ਹਾਂਜੀ ਸਾਸਰੀਕਾਲ ਜੀ ਮੈਂ ਪਠਾਨਕੋਟ ਤੋਂ ਹਰਜੀਤ ਕੌਰ ਬੋਲ ਰਹੀ ਹਾਂ ਜਿਵੇਂ ਕਿ ਸਦੀਆਂ ਤੋਂ ਹੀ ਚੱਲਿਆ ਆ ਰਿਹਾ ਕਿ ਸਾਡਾ ਪੰਜਾਬ ਇੱਕ ਬਹੁਤ ਖੂਬਸੂਰਤ ਇਲਾਕਾ ਹੈ ਜ ਜੋ ਗੁਰੂਆਂ ਪੀਰਾਂ ਝਰਨੇ ਨਦੀਆਂ ਝੀਲਾਂ ਪਹਾੜਾਂ ਖੇਤਾਂ ਆਦਿ ਦੇ ਨਾਲ ਮ ਮਸ਼ਹੂਰ ਹਨ ਜਿਵੇਂ ਕਿ ਸਾਡੇ ਪਠਾਨਕੋਟ ਦੇ ਵਿੱਚ ਜਿਵੇਂ ਅਸੀਂ ਜਾਈਏ ਉੱਥੇ ਕਾਫ਼ੀ ਦੇਖਣ ਨੂੰ ਸੁੰਦਰ ਨਜ਼ਾਰੇ ਮਿਲਦੇ ਹਨ ਕਿਉਂਕਿ ਜੋ ਮਿੰਨੀ ਗੋਆ ਹੈ ਉਹਦੇ ਨਾਲ ਵੀ ਇੱਕ ਨਹਿਰ ਲੱਗਦੀ ਹੈ ਜੋ ਕਿ ਦੇਖਣ ਨੂੰ ਬਹੁਤ ਸੁੰਦਰ ਲੱਗਦੀ ਹੈ ਲੋਕ ਦੂਰੋਂ ਦੂਰ ਦੇਖਣ ਆਉਂਦੇ ਹਨ ਜੋ ਰਣਜੀਤ ਸਾਗਰ ਡੈਮ ਹੈ ਇੱਕ ਇੱਕ ਪਾਣੀ ਦੇ ਝਰਨਿਆਂ ਨਾਲ ਭਰਿਆ ਹੋਇਆ ਇੱਕ ਡੈਮ ਹੈ ਜੋ ਲੋਕ ਦੂਰੋਂ ਦੂਰੋਂ ਦੇਖਣ ਆਉਂਦੇ ਲੋਕ ਇਹਨਾਂ ਨਜ਼ਾਰਿਆਂ ਨੂੰ ਨਜ਼ਾਰਿਆਂ ਨੂੰ ਦੇਖਣ ਆਉਂਦੇ ਹਨ ਅਤੇ ਚਾਹੁੰਦੇ ਹਾਂ ਕਿ ਹਰ ਕੋਈ ਇੱਥੇ ਵਿਜਿਟ ਕਰਨ ਆਵੇ ਅਤੇ ਇਹਨਾਂ ਨੂੰ ਨਜ਼ਾਰਿਆਂ ਦਾ ਆਨੰਦ ਮਾਣੇ ਅਤੇ ਇਹਨਾਂ ਨੂੰ ਦੇਖ ਕੇ ਜਾਵੇ ਉਸ ਤਰ੍ਹਾਂ ਕਿਉਂਕਿ ਸਾਡੇ ਪੰਜਾ ਪੰਜਾਬ ਦੇ ਅੰਦਰ ਖੇਤਾਂ ਦੇ ਵਿੱਚ ਵੀ ਬੜੀ ਖੂਬਸੂਰਤੀ ਹੈ ਸ ਸੁਬਹੇ ਦੀ ਸਵੇਰ ਖੇਤਾਂ ਦੇ ਵਿੱਚ ਬਹੁਤ ਅੱਛੀ ਲੱਗਦੀ ਹੈ ਜਿਵੇਂ ਕਿ ਸੁਬਹੇ ਉੱਠਦੇ ਹਾਂ ਅਤੇ ਹਰੇ ਹ ਹਰੇ ਭਰੇ ਖੇਤ ਜੋ ਹੈ ਆਪਣੇ ਮਨ ਨੂੰ ਆਪਣੇ ਸਰੀ ਦਿਲ ਨੂੰ ਸਾਰਾ ਦਿਨ ਸ਼ਾਂਤੀ ਆਪਣੇ ਸਰੀਰ ਮਨ ਦੇ ਅੰਦਰ ਸ਼ਾਂਤੀ ਪ੍ਰਦਾਨ ਕਰਦੇ ਹਨ ਇਸ ਤਰ੍ਹਾਂ ਅਸੀਂ ਕਹਿੰਦੇ ਹਾਂ ਕਿ ਜੋ ਵੀ ਆਵੇ ਪੰਜਾਬ ਵਿੱਚ ਆਵੇ ਅਤੇ ਇਹਨਾਂ ਇਹਨਾਂ ਥਾਵਾਂ ਨੂੰ ਵਿਜਿਟ ਕਰਕੇ ਜਾਵੇ